ਛੱਬੀ ਅਗਸਤ ਦੋ ਹਜ਼ਾਰ ਤੇਈ ਇੱਕ ਜਨਵਰੀ ਦੋ ਹਜ਼ਾਰ ਇੱਕੀ ਚਾਰ ਜੁਲਾਈ ਦੋ ਹਜ਼ਾਰ ਵੀਹ ਉਨੱਤੀ ਜੂਨ ਦੋ ਹਜ਼ਾਰ ਤੇਈ ਦੋ ਅਕਤੂਬਰ ਦੋ ਹਜ਼ਾਰ ਦਸ